ਮੈਂ ਬਿਜਲੀ ਮਹਿਕਮੇ ਵਿੱਚ ਉੱਨੀ ਸੌ ਤ੍ਰਿਆਸੀ ਨੂੰ ਫੋਰਮੈਨ ਡਿਊਟੀ ਜੁਆਈਨ ਕੀਤੀ ਸੀ ਅਤੇ ਉਸ ਤੋਂ ਬਾਅਦ ਮੈਂ ਡਿਊਟੀ ਜਿਹੜੀ ਹੈ ਫੋਰਮੈਨ ਦੀ ਪੋਸਟ ਤੋਂ ਜੇਈ ਦੀ ਸ਼ਿਫ ਜੁਆਈਨ ਕਰ ਲਈ ਉਸ ਸਕੇਲ 'ਤੇ ਅਤੇ ਵੱਖ ਵੱਖ ਜਗ੍ਹਾ ਮੈਂ ਰਿਹਾ ਜਿਵੇਂ ਕਿ ਰੋਪੜ ਵੀ ਰੂਪਨਗਰ ਪਟਿਆਲਾ ਬਠਿੰਡਾ ਨਾਗਪੁਰ ਵੀ ਸਾਰੇ ਪਾਸੇ ਮੈਂ ਕੰਮ ਕੀਤਾ ਅਤੇ ਦੋ ਹਜ਼ਾਰ ਬਾਰ੍ਹਾਂ ਵਿੱਚ ਮੈਂ ਐੱਸ ਡੀ ਓ ਪ੍ਰਮੋਸ਼ਨ ਹੋ ਗਈ ਮੇਰੀ ਅਤੇ ਤਕਰੀਬਨ ਮੈਂ ਨੌ ਸਾਲ ਐੱਸ ਡੀ ਓ ਰਿਹਾ ਅਤੇ ਐੱਸ ਡੀ ਓ ਬਣਨ 'ਤੇ ਸਾਰੇ ਪਰਿਵਾਰ ਨੂੰ ਬੜੀ ਖੁਸ਼ੀ ਹੋਈ ਅਤੇ ਮੇਰਾ ਡਿਊਟੀ ਦਾ ਸਫ਼ਰ ਬਹੁਤ ਰਿਹਾ ਉੱਥੇ ਹਰ ਹਰ ਸਾਲ ਮੈਨੂੰ ਇਨਾਮ ਵਜੋਂ ਸਰਟੀਫਿਕੇਟ ਮਿਲਦੇ ਸਨ ਅਤੇ ਰਿਟਾਇਰਮੈਂਟ ਹੋਣ ਤੋਂ ਬਾਅਦ ਵੀ ਮਹਿਕਮਾ ਮੈਨੂੰ ਦੁਬਾਰਾ ਬੁਲਾਇਆ ਗਿਆ ਅਤੇ ਛੇ ਮਹੀਨੇ ਮੈਂ ਡਿਊਟੀ ਕਰੀ ਅਤੇ ਉਸ ਤੋਂ ਬਾਅਦ ਮੈਂ ਨਹੀਂ ਡਿਊਟੀ ਛੱਡ ਦਿੱਤੀ ਅਤੇ ਹੁਣ ਵੀ ਮਹਿਕਮਾ ਮੈਨੂੰ ਬੁਲਾ ਰਿਹਾ ਡਿਊਟੀ 'ਤੇ